ਅੰਮ੍ਰਿਤਸਰ ਸਾਰੇ ਸੰਸਾਰ ਵਿੱਚ ਬਹੁਤ ਮਸ਼ਹੂਰ ਹੈ ਸਾਰੇ ਸੰਸਾਰ ਤੋਂ ਸਭ ਤੋਂ ਜ਼ਿਆਦਾ ਲੋਕ ਘੁੰਮਣ ਲਈ ਅੰਮ੍ਰਿਤਸਰ ਹੀ ਆਉਂਦੇ ਹਨ ਇਹ ਰੂਹਾਨੀਅਤ ਦਾ ਕੇਂਦਰ ਹੈ ਇਸ ਨੂੰ ਅੰਮ੍ਰਿਤਸਰ ਸਿਫਤੀ ਦਾ ਘਰ ਕਿਹਾ ਜਾਂਦਾ ਹੈ ਇਹ ਹੁਣ ਸਮਾਰਟ ਸਿਟੀ ਵੀ ਬਣ ਗਈ ਹੈ ਇਸ ਅੰਮ੍ਰਿਤਸਰ ਵਿੱਚ ਸਾਫ਼ ਸਫ਼ਾਈ ਅਤੇ ਸੁੰਦਰਤਾ ਕਾਇਮ ਰੱਖਣੀ ਬਹੁਤ ਜ਼ਰੂਰੀ ਹੈ ਇਸ ਦੀ ਪਹਿਲ ਕਦਮੀ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਆਲੇ ਦੁਆਲੇ ਪਾਰਕ ਵਿੱਚ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਆਕਸੀਜਨ ਮਿਲ ਸਕੇ ਅਤੇ ਅਸੀਂ ਤੰਦਰੁਸਤ ਰਹਿ ਸਕੀਏ ਸਾਨੂੰ ਘਰਾਂ ਵਿੱਚ ਬਾਹਰ ਕੂੜੇਦਾਨ ਰੱਖਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਸਾਫ਼ ਰਹੇ ਅਤੇ ਕੁਝ ਅਜਿਹੇ ਲੋਕ ਜੋ ਕਿ ਵੱਧ ਗੰਦਗੀ ਪਾ ਕੇ ਰੱਖਦੇ ਹਨ ਅਤੇ ਸਾਡੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ ਸਾਡੇ ਲਈ ਇਹ ਵੱਡੀ ਚੁਣੌਤੀ ਹੈ ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖ ਕੇ ਆਪਣਾ ਵਾਤਾਵਰਨ ਸ਼ੁੱਧ ਕਰ ਸਕਦੇ ਹਾਂ